ਮੈਂ ਹਰ ਵਾਰ ਜਦੋਂ ਵੀ ਕੋਈ ਚੀਜ਼ ਲੈਣੀ ਹੁੰਦੀ ਹੈ ਤਾਂ ਇੰਟਰਨੈੱਟ ਦੇ ਉੱਤੋਂ ਹੀ ਲੈਂਦੀ ਹਾਂ ਕਿਉਂਕਿ ਔਨਲਾਈਨ ਸ਼ੋਪਿੰਗ ਦੇ ਵਿੱਚ ਇੱਦਾਂ ਆ ਕਿ ਇੱਕ ਤਾਂ ਮੇਰਾ ਟਾਈਮ ਬਚਦਾ ਆ ਅਤੇ ਦੂਜਾ ਮੈਨੂੰ ਜੋ ਚੀਜ਼ ਬਾਜ਼ਾਰ ਦੇ ਵਿੱਚ ਮਹਿੰਗੀ ਮਿਲਦੀ ਆ ਉਹ ਔਨਲਾਈਨ ਪਲੈਟਫੋਰਮ ਦੇ ਉੱਤੇ ਮੈਨੂੰ ਉਹ ਚੀਜ਼ ਸਸਤੀ ਮਿਲਦੀ ਹੈ ਸੋ ਇਸ ਕਰਕੇ ਮੈਂ ਹਰ ਵਾਰੀ ਇੰਟਰਨੈੱਟ ਦੇ ਉੱਤੋਂ ਹੀ ਮੰਗਾਉਨੀ ਹਾਂ ਜੋ ਵੀ ਮੰਗਾਉਣਾ ਹੁੰਦਾ ਅਤੇ ਪਿੱਛੇ ਜਿਹੇ ਮੈਂ ਇਸ ਵਾਰੀ ਜੈਕਿਟ ਮੰਗਵਾਈ ਸੀ ਇੱਕ ਵੂਲਨ ਜੈਕਿਟ ਅਤੇ ਮੈਨੂੰ ਫੋਟੋ ਦੇ ਵਿੱਚੋਂ ਬਹੁਤ ਹੀ ਜ਼ਿਆਦਾ ਸੋਹਣੀ ਲੱਗੀ ਅਤੇ ਉੱਦਾਂ ਦੀ ਸੇਮ ਜੈਕਿਟ ਮੈਂ ਮਾਰਕੀਟ ਦੇ ਵਿੱਚ ਦੇਖੀ ਸੀਗੀ ਤਾਂ ਉਹਦਾ ਪ੍ਰਾਈਜ਼ ਮੈਨੂੰ ਜ਼ਿਆਦਾ ਲੱਗਿਆ ਤਾਂ ਮੈਂ ਉਹਦੀ ਫੋਟੋ ਖਿੱਚ ਕੇ ਅਤੇ ਔਨਲਾਈਨ ਜਦੋਂ ਚੈੱਕ ਕੀਤੀ ਤਾਂ ਉਹਦਾ ਪ੍ਰਾਈਜ਼ ਕੁਛ ਜ਼ਿਆਦਾ ਖ਼ਾਸ ਨਹੀਂ ਸੀਗਾ ਤਾਂ ਮੈਂ ਜਦੋਂ ਔਡਰ ਕੀਤਾ ਉਹਨੂੰ ਜਦੋਂ ਔਡਰ ਮੇਰੇ ਕੋਲ ਪਹੁੰਚਿਆ ਤਾਂ ਉਹ ਜਿਹੜਾ ਉਹਦਾ ਵੂਲਨ ਦਾ ਸਟੱਫ ਸੀਗਾ ਬਹੁਤ ਹੀ ਜ਼ਿਆਦਾ ਗਰਮ ਅਤੇ ਬਹੁਤ ਹੀ ਸੋਹਣਾ ਸਟੱਫ ਸੀਗਾ ਮੈਂ ਜਦੋਂ ਉਹ ਜੈਕਿਟ ਪਾਈ ਤਾਂ ਸੱਚੀ ਬਹੁਤ ਹੀ ਮੈਨੂੰ ਉਹ ਸਕੂਨ ਦਿੱਤਾ ਉਹਨੇ ਕਿਉਂਕਿ ਉਹ ਠੰਡ ਤੋਂ ਬਚਾਉਣ ਦੇ ਲਈ ਮੇਰੇ ਲਈ ਉਹ ਜੈਕਿਟ ਬਹੁਤ ਹੀ ਵਧੀਆ ਸੀ ਕਿਉਂਕਿ ਮੈਂ ਅਪ ਡਾਊਨ ਕਰਨਾ ਹੁੰਦਾ ਹੈ ਅਤੇ ਮੇਰੇ ਲਈ ਉਹ ਜੈਕਿਟ ਬਹੁਤ ਜ਼ਿਆਦਾ ਵਧੀਆ ਸੀਗੀ ਅਤੇ ਫਿਟਿੰਗ ਵੀ ਉਹਦੀ ਬਹੁਤ ਸੋਹਣੀ ਆਈ ਉਹ ਜੈਕਟ ਦੀ ਅਤੇ ਔਨਲਾਈਨ ਚੀਜ਼ਾਂ ਮਾੜੀਆਂ ਨਹੀਂ ਹੁੰਦੀਆਂ ਪ੍ਰਾਈਜ਼ ਵੀ ਸਾਨੂੰ ਵਧੀਆ ਮਿਲ ਜਾਂਦੇ ਨੇ ਔਨਲਾਈਨ ਦੇ ਉੱਤੇ ਅਤੇ ਜਿਹੜੀ ਵੂਲਨ ਜੈਕਿਟ ਮੰਗਵਾਈ ਸੀਗੀ ਮੈਂ ਉਹ ਵੀ ਬਹੁਤ ਜ਼ਿਆਦਾ ਵਧੀਆ ਸਟੱਫ ਵੀ ਵਧੀਆ ਸੀਗਾ ਕੁਆਲਿਟੀ ਵੀ ਵਧੀਆ ਸੀ ਉਹਦੀ ਅਤੇ ਮੈਂ ਹੰਡਾਈ ਵੀ ਬਹੁਤ ਜ਼ਿਆਦਾ ਆ